ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ਼ ਜਨਮਦਿਨ ਅਤੇ ਵਿਆਹ ਦੇ ਬਹੁਤ ਸਾਰੇ ਖਾਸ ਮੌਕੇ ਬਹੁਤ ਵਧੀਆ ਤਰੀਕੇ ਨਾਲ਼ ਸੈਲੀਬ੍ਰੇਟ ਕਰਦੀ ਹਾਂ ਪਰ ਮੈਨੂੰ ਆਪਣੇ ਪਰਿਵਾਰ ਨਾਲ਼ ਜਨਮਦਿਨ ਜਾਂ ਕੋਈ ਵਿਆਹ ਕੋਈ ਅਚੀਵਮੈਂਟ ਜਾਂ ਕੋਈ ਤਿਉਹਾਰ ਸੈਲੀਬ੍ਰੇਟ ਕਰਨਾ ਬਹੁਤ ਵਧੀਆ ਲੱਗਦਾ ਹੈ ਅਸੀਂ ਕੋ ਸਾਰੇ ਜਣੇ ਬਹੁਤ ਇੰਜੋਏ ਕਰਦੇ ਹਾਂ ਜਦੋਂ ਵੀ ਕੋਈ ਕੁਝ ਵੀ ਹੁੰਦਾ ਏ ਘਰ 'ਚ ਜਦੋਂ ਸਾਡੇ ਘਰ 'ਚ ਕੋਈ ਜਨਮਦਿਨ ਹੁੰਦਾ ਹੈ ਤਾਂ ਅਸੀਂ ਘਰ ਹੀ ਕੇਕ ਬਣਾ ਲੈਂਦੇ ਹਾਂ ਅਤੇ ਹੋਰ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਬਣਾ ਲੈਂਦੇ ਹਾਂ ਕਿਉਂਕਿ ਮੇਰੇ ਮੰਮੀ ਡੈਡੀ ਨੂੰ ਬਾਹਰੋਂ ਨਹੀਂ ਕੁਝ ਵੀ ਮੰਗਾਉਣਾ ਕੁਝ ਬਾਹਰ ਦਾ ਖਾਣਾ ਬਿਲਕੁਲ ਨਹੀਂ ਪਸੰਦ ਹੈ ਇਸ ਕਰਕੇ ਅਸੀਂ ਘਰ ਹੀ ਕੇਕ ਬਣਾ ਲੈਂਦੇ ਹਾਂ ਘਰ ਹੀ ਖਾਣ ਪੀਣ ਨੂੰ ਜੋ ਵੀ ਸਾਡਾ ਮਨ ਕਰਦਾ ਹੈ ਉਹ ਬਣਾ ਲੈਂਦੇ ਹਾਂ ਅਤੇ ਜਦੋਂ ਵੀ ਕੋਈ ਵੀ ਕੋਂਪੀਟੀਸ਼ਨ ਹੁੰਦਾ ਏ ਮੇਰਾ ਕੋਈ ਵੀ ਐੱਸੇ ਰਾਈਟਿੰਗ ਕੋਂਪੀਟੀਸ਼ਨ ਸਪੀਚ ਕੋਂਪੀਟੀਸ਼ਨ ਜਾਂ ਡਰਾਇੰਗ ਕੋਂਪੀਟੀਸ਼ਨ ਕੁਝ ਵੀ ਹੁੰਦਾ ਹੈ ਤਾਂ ਮੈਂ ਮੈਨੂੰ ਕੋਈ ਵੀ ਪ੍ਰਾਈਜ਼ ਮਿਲਦਾ ਹੈ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ਼ ਸੈਲੀਬ੍ਰੇਟ ਕਰਦੇ ਹਾਂ ਅਤੇ ਵੱਡਿਆਂ ਦੀਆਂ ਵੱਡਿਆਂ ਤੋਂ ਆਸ਼ੀਰਵਾਦ ਲੈਂਦੇ ਹਾਂ ਸਭ ਦੀ ਸਭ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਐਪਰੀਸ਼ੀਏਟ ਕਰਦੇ ਨੇ ਅਤੇ ਮੈਨੂੰ ਬਲੈਸਿੰਗਸ ਦਿੰਦੇ ਨੇ ਅਤੇ ਵਿਆਹ ਵਿਆਹ ਦਾ ਸਭ ਤੋਂ ਖਾਸ ਪਲ ਮੈਂ ਤੁਹਾਡੇ ਨਾਲ ਜੋ ਸਾਂਝਾ ਕਰ ਮੇਰਾ ਸਭ ਤੋਂ ਖਾਸ ਪਲ ਹੈ ਜੋ ਤਜਰਬਾ ਮੇਰੀ ਜ਼ਿੰਦਗੀ ਦਾ ਉਹ ਮੇਰਾ ਇਹ ਹੈ ਕਿ ਮੇਰੇ ਕਜ਼ਨ ਦੀ ਮੈਰਿਜ਼ ਸੀ ਦੋ ਸਾਲ ਪਹਿਲਾਂ ਦੋ ਹਜ਼ਾਰ ਇੱਕੀ ਉੱਨੀ ਵੀਹ ਨਵੰਬਰ ਨੂੰ ਉਹਨਾਂ ਦਾ ਵਿਆਹ ਸੀ ਅਤੇ ਅਸੀਂ ਬਹੁਤ ਇੰਜੋਏ ਕੀਤਾ ਬਹੁਤ ਭੰਗੜਾ ਪਾਇਆ ਬਹੁਤ ਸਾਰੀ ਸ਼ੋਪਿੰਗ ਕੀਤੀ ਆਪਣੇ ਮਨ ਪਸੰਦ ਦੀ ਸ਼ੋਪਿੰਗ ਕੀਤੀ ਅਤੇ ਸਾਰਾ ਕੁਝ ਆਪਣੀ ਮਨ ਪਸੰਦ ਦਾ ਲਿਆ ਅਤੇ ਬਹੁਤ ਬਹੁਤ ਮਜ਼ਾ ਆਇਆ ਸਾਨੂੰ ਸਾਰਿਆਂ ਨੂੰ ਅਤੇ ਇੰਨਾ ਸੈਲੀਬ੍ਰੇਟ ਕੀਤਾ ਅਸੀਂ ਭੰਗੜਾ ਪਾਇਆ ਇੰਨੇ ਪੰਦਰ੍ਹਾਂ ਦਿਨ ਪਹਿਲਾਂ ਹੀ ਅਸੀਂ ਗਿੱਧਾ ਪਾਉਣਾ ਸਟਾਟ ਕਰ ਦਿੱਤਾ ਸੀ ਅਤੇ ਇੰਨਾ ਮਜ਼ਾ ਹੋਇਆ ਨਾ ਬਸ ਇਹ ਮੇਰੀ ਜ਼ਿੰਦਗੀ ਦਾ ਵਿਆ ਹੁਣ ਤੱਕ ਦਾ ਜੋ ਵੀ ਹੈ ਵਿਆਹ ਦਾ ਸਭ ਤੋਂ ਖਾਸ ਪਲ ਹੈ